ਹਾਂਜੀ ਵ ਨਵੇਂ ਅਤੇ ਪੁਰਾਣਿਆਂ ਦਾ ਫਰਕ ਇਹ ਹੈ ਜੀ ਅਗਲੇ ਤਾਂ ਰੇਡੂਏ ਸੁਣਦੇ ਸੀ ਅਤੇ ਬੈਠੇ ਅਖਬਾਰ ਵੀ ਪੜ੍ਹ ਲੈਂਦੇ ਸੀ ਹੁਣ ਦੇ ਅੱਜ ਕੱਲ੍ਹ ਦੇ ਬੱਚੇ ਤਾਂ ਬਸ ਜੀ ਟੀ ਵੀ ਲਾ ਲੈਣਗੇ ਟੀਵੀਆਂ ਤੋਂ ਮੋਬਾਇਲ ਲਾ ਲੈਣਗੇ ਕੰਮ ਛੁੱਟ ਜਾਂਦਾ ਅਤੇ ਬੈ ਟੈਮ ਪਾਸ ਉਹਨਾਂ 'ਚ ਹੋ ਜਾਂਦਾ ਅਤੇ ਅਗਲੇ ਪੁਰਾਣੇ ਬੰਦੇ ਨਾਲੇ ਕੰਮ ਕਰੀ ਜਾਂਦੇ ਨਾਲੇ ਰੇਡੂਏ ਸੁਣੀ ਜਾਂਦੇ ਨਾਲੇ ਬੈਠੇ ਦੋ ਮਿੰਟ ਚਾਰ ਮਿੰਟ ਅਖਬਾਰ ਵੀ ਪੜ੍ਹ ਲੈਂਦੇ ਹੋਰ ਵੀ ਕੰਮ ਕਰ ਲੈਂਦੇ ਹੁਣ ਦੇ ਤਾਂ ਬਸ ਕੋਈ ਆਖੇ ਹੀ ਨਹੀਂ ਲੱਗਦਾ ਹੁਣ ਤਾਂ ਬੱਚਾ ਇੱਕ ਵੱਡਾ ਇੱਕ ਛੋਟਾ ਇੱਕ ਸਭ ਮਬਾਈਲਾਂ ਦੇ ਵਿੱਚ ਵੜੇ ਪਏ ਨੇ ਹੁਣ ਪੁਰਾਣਿਆਂ ਨੂੰ ਕਿਹੜਾ ਸਮਝਦਾ ਅਤੇ ਹੁਣ ਤਾਂ ਬਸ ਜੀ ਮੋਬਾਇਲ ਅਤੇ ਜਾਂ ਟੀ ਵੀ ਆ ਹੋਰ ਤਾਂ ਕੀ ਹੈ ਹੁਣ ਤਾਂ ਪੁਰਾਣੇ ਅਤੇ ਨਵਿਆਂ ਦਾ ਬਹੁਤ ਫਰਕ ਪੈ ਗਿਆ ਤਾਂ ਪੁਰਾਣੇ ਤਾਂ ਪੁਰਾਣੇ ਰਹਿ ਗਏ ਨਵੇਂ ਤਾਂ ਨਵੇਂ ਰਹਿ ਗਏ ਠੀਕ ਹੈ